ਗੁਡ ਈਵਨਿੰਗ ਬਸ ਠੀਕ ਆ ਵਧੀਆ ਜ਼ਰੂਰ ਜ਼ਰੂਰ ਦੱਸਣੀ ਚਾਹੀਦੀ ਮੂਵੀ ਪਰ ਮੈਨੂੰ ਪਤਾ ਲੱਗਾ ਕਿ ਆਪਣੇ ਲਾਗੇ ਅੰਮ੍ਰਿਤਸਰ ਸ਼ਹਿਰ ਵਿੱਚ ਸ਼ੂਟਿੰਗ ਹੋ ਰਹੀ ਹੈ ਫਿਲਮ ਦੀ ਪਰਦੇ ਦੇ ਨਵੀਂ ਫਿਲਮ ਹੈ ਕੋਈ ਉਡਤੇ ਪੰਜਾਬ ਇਹਨਾਂ ਦੀ ਸ਼ੂਟਿੰਗ ਹੋ ਰਹੀ ਬਾਲੀਵੁੱਡ ਦੀ ਸ਼ੂਟਿੰਗ ਚੱਲ ਰਹੀ ਹੈ ਇਹ ਪੜਦੇ 'ਤੇ ਆਪਾਂ ਬਹੁਤ ਦੇਖੇ ਕਲਾਕਾਰ ਬਾਏ ਫੇਸ ਦੇਖੀਏ ਉਹਦਾ ਦੇਖਣ ਦਾ ਨਜ਼ਾਰਾ ਹੀ ਕੁਝ ਹੋਰ ਹੋਏਗਾ ਹਾਂ ਓਹ ਜੋ ਬਾਈ ਫੇਸ ਦੇਖਣਾ ਉਹ ਹੋਰ ਮਜ਼ਾ ਆਏਗਾ ਦੇਖਣ ਦਾ ਜ਼ਰੂਰ ਜ਼ਰੂਰ ਹਾਂ ਹਾਂ ਜ਼ਰੂਰ ਜਾਵਾਂਗੇ ਫਿਲਮ ਦੇਖ ਕੇ ਆਵਾਂਗੇ ਅਜੇ ਹੈਗੀ ਦਸ ਦਿਨ ਤੱਕ ਸ਼ੂਟਿੰਗ ਚੱਲਣੀ ਹੈ ਜੀ ਜ਼ਰੂਰ ਜ਼ਰੂਰ ਸੰਡੇ ਦਾ ਰੱਖਾਂਗੇ ਨਾਲੇ ਪਰਿਵਾਰ ਨੂੰ ਲੈ ਕੇ ਜਾ ਕੇ ਪੜਦੇ 'ਤੇ ਬਹੁਤ ਦੇਖੇ ਉਹਨਾਂ ਨੇ ਫਿਲਮਾਂ ਬਾਏ ਫੇਸ ਦਿਖਾ ਕੇ ਲਿਆਵਾਂਗੇ ਉਹਨਾਂ ਨੂੰ ਜ਼ਰੂਰ ਜ਼ਰੂਰ ਹਾਂ ਠੀਕ ਹੈ ਆਇਓ ਨੌ ਵਜੇ ਤੱਕ ਓਕੇ ਓਕੇ